ਸਾਡਾ ਅਸੀਂ ਇੱਕ ਵਾਰ ਵ ਔਨਲਾਈਨ ਕਿਸੇ ਵੈਬਸਾਈਟ ਤੋਂ ਮੋਬਾਇਲ ਖਰੀਦਿਆ ਸੀ ਜੋ ਮੋਬਾਇਲ ਖਰੀਦਿਆ ਸੀ ਉਸ ਵਿੱਚ ਇਹ ਦਿੱਕਤ ਆਈ ਕਿ ਜਦੋਂ ਵੀ ਸਾਨੂੰ ਇਸ ਮੋਬਾਇਲ ਵਿੱਚ ਦਿੱਕਤ ਆਈ ਇਲੈਕਟ੍ਰੋਨਿਕਸ ਦੇ ਪਾਰਟ ਦੇ ਵਿੱਚ ਜਦੋਂ ਅਸੀਂ ਕੰਸਟਮ ਕੇਅਰ ਦੇ ਸਰਵਿਸ ਸੈਂਟਰ 'ਤੇ ਗਏ ਤਾਂ ਉਹ ਕਹਿੰਦੇ ਜੀ ਤੁਸੀਂ ਬਿੱਲ ਦਿਖਾਉ ਅਤੇ ਬਿੱਲ ਜੋ ਔਨਲਾਈਨ ਵਾਲਾ ਹੈ ਇਸਨੂੰ ਬਹੁਤ ਘੱਟ ਮਤਲਬ ਸਰਵਿਸ ਸੈਂਟਰਾਂ ਵਾਲੇ ਐਸੈਪਟ ਕਰਦੇ ਹਨ ਸਾਡਾ ਅਨੁਭਵ ਇਹ ਹੈ ਵੀ ਜ਼ਿਆਦਾਤਰ ਮੋਬਾਇਲ ਦੇਖ ਕੇ ਔਨਲਾਈਨ ਨਹੀਂ ਲੈਣਾ ਚਾਹੀਦਾ ਦੁਕਾਨ 'ਤੇ ਜਾ ਕੇ ਦੇਖ ਕੇ ਪਰਖ ਕੇ ਹੀ ਲੈਣਾ ਚਾਹੀਦਾ ਹੈ ਸਾਡਾ ਅਨੁਭਵ ਇੰਨਾ ਵਧੀਆ ਨਹੀਂ ਰਿਹਾ ਅਤੇ ਇੱਕ ਤਾਂ ਮੋਬਾਇਲ ਹੈ ਜੋ ਅਸੀਂ ਦੇਖਦੇ ਹਾਂ ਆਪਣੇ ਹੱਥ ਦੇ ਵਿੱਚ ਫੜ ਕੇ ਕੋਈ ਵੀ ਮਾਡਲ ਹੈ ਉਸ ਦੀ ਡੰਮੀ ਦੁਕਾਨਾਂ 'ਤੇ ਪਈ ਹੁੰਦੀ ਹੈ ਅਤੇ ਅਸੀਂ ਉਸ ਡੰਮੀ ਨੂੰ ਦੇਖ ਕੇ ਇੱਕ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੋ ਮੋਬਾਇਲ ਅਸੀਂ ਲੈਣ ਲੱਗੇ ਹਾਂ ਜਾਂ ਕੋਈ ਵੀ ਪ੍ਰੋਡਕਟ ਅਸੀਂ ਲੈਣ ਲੱਗੇ ਹਾਂ ਤਾਂ ਉਹ ਇਹ ਇੱਦਾਂ ਦਾ ਹੋਵੇਗਾ ਅਤੇ ਪਰ ਔ ਫੋਟੋ ਅਤੇ ਅਸਲ ਦੇਖਣ ਦੇ ਵਿੱਚ ਬਹੁਤ ਅੰਤਰ ਹੁੰਦਾ ਹੈ ਜਦੋਂ ਅਸੀਂ ਔਨਲਾਈਨ ਕਿਸੇ ਵੀ ਵੈਬਸਾਈਟ ਤੋਂ ਮੋਬਾਈਲ ਦੇਖਦੇ ਹਾਂ ਤਾਂ ਸਾਨੂੰ ਉਹ ਦੇਖਣ ਵਾਸਤੇ ਵਧੀਆ ਲੱਗਦਾ ਹੈ ਪਰ ਜਦੋਂ ਉਹ ਸਾਡੇ ਹੱਥ ਦੇ ਵਿੱਚ ਆਉਂਦਾ ਹੈ ਤਾਂ ਉਸ ਨੂੰ ਦੇਖ ਕੇ ਅਸੀਂ ਕਹਿੰਦੇ ਹਾਂ ਇਸ ਦਾ ਕੈਮਰਾ ਇੱਦਾਂ ਲੱਗਦਾ ਹੈ ਇਸਦਾ ਵਜ਼ਨ ਜ਼ਿਆਦਾ ਹੈ ਇਸ ਦਾ ਵੇਟ ਜ਼ਿਆਦਾ ਹੈ ਸਾਡਾ ਅਨੁਭਵ ਇਹ ਹੈ ਕਿ ਜ਼ਿਆਦਾਤਰ ਮੋਬਾਇਲ ਦੇਖ ਕੇ ਹੀ ਲੈਣੇ ਚਾਹੀਦੇ ਹਨ